ਮੈਂ ਚਿੜੀਆ ਘਰ ਤਾਂ ਨਹੀਂ ਗਈ ਪਰ ਮੈਂ ਅਜਿਹੇ ਦੁਰਲੱਭ ਪੰਛੀ ਜਿਹੜੇ ਕਿ ਵੇਖੇ ਹਨ ਇੱਕ ਦਿਨ ਮੈਂ ਆਪਣੇ ਘਰ ਦੀ ਛੱਤ ਤੇ ਬੈਠੀ ਸੀ ਇੱਕ ਅਜੀਬ ਹੀ ਤਰ੍ਹਾਂ ਦੀ ਚਿੜੀ ਨੂੰ ਮੈਂ ਵੇਖਿਆ ਜਿਸ ਦਾ ਰੰਗ ਬੜਾ ਹੀ ਸੋਹਣਾ ਸੀ ਜਿਵੇਂ ਕੀ ਨੀਲੇ ਰੰਗ ਦਾ ਜਿਵੇਂ ਮੋਰ ਦਾ ਨੀਲਾ ਰੰਗ ਹੁੰਦਾ ਹੈ ਉਸ ਪੰਛੀ ਦੀ ਚਮਕ ਵੀ ਬਹੁਤ ਸੁੰਦਰ ਸੀ ਉਸਦੀ ਚੁੰਝ ਅੱਗੇ ਨੂੰ ਵਧੀ ਹੋਈ ਸੀ ਅਜੀਬ ਈ ਤਰ੍ਹਾਂ ਦੀ ਉਸਦੀ ਅਵਾਜ਼ ਸੀ ਮੈਂ ਤੇ ਇਹ ਸੋਚਦੀ ਹੀ ਰਹਿ ਗਈ ਕਿ ਇਹ ਪੰਛੀ ਆਖ਼ਿਰ ਆਇਆ ਕਿਧਰੋਂ ਮੈਨੂੰ ਤਾਂ ਇਹ ਵੀ ਨੀ ਲੱਗਦਾ ਸੀ ਕੀ ਉਹ ਮੇਰਾ ਭਾਰਤੀ ਪੰਛੀ ਹੈ ਮੀਨਜ ਉਹ ਇੰਝ ਜਾਪਿਆ ਜਿਵੇਂ ਕੀ ਉਹ ਪ੍ਰਦੇਸਾਂ ਤੋਂ ਉੱਡਦਾ ਉੱਡਦਾ ਮੇਰੇ ਘਰ ਵੱਲ਼ ਨੂੰ ਆ ਗਿਆ ਉਸ ਪੰਛੀ ਦੀ ਛਾਪ ਮੇਰੇ ਮਨ ਵਿੱਚ ਅੱਜ ਵੀ ਹੈ ਅੱਜ ਵੀ ਮੈਂ ਅੱਖਾਂ ਬੰਦ ਕਰਾਂ ਤਾਂ ਮੈਂ ਉਸ ਪੰਛੀ ਨੂੰ ਦੇਖ ਸਕਦੀ ਆਂ ਮੈਨੂੰ ਉਸਦਾ ਰੰਗ ਉਸਦੀ ਅਵਾਜ਼ ਉਸਦੇ ਉਸਦੀ ਚੁੰਝ ਉਸਦੇ ਬੈਠਣ ਦਾ ਤਰੀਕਾ ਕਦੇ ਨੀ ਭੁੱਲਿਆ ਪੰਛੀ ਤਾਂ ਮੈਂ ਬਹੁਤ ਵੇਖੇ ਨੇ ਮੇਰੇ ਘਰਾਂ ਚ ਕਬੂਤਰ ਵੀ ਆਉਂਦੇ ਨੇ ਚਿੜੀਆਂ ਵੀ ਆਉਂਦੇ ਨੇ ਕਾਂ ਵੀ ਆਉਂਦੇ ਨੇ ਲੇਕਿਨ ਉਹ ਇੱਕ ਅਜੀਬ ਕਿਸਮ ਦੀ ਚਿੜੀ ਸੀ ਜਿਹੜੀ ਕੀ ਮੇਰੇ ਅੱਖਾਂ ਨੂੰ ਏਨੀ ਕੀ ਮੋਹ ਗਈ ਕੀ ਅੱਜ ਵੀ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ ਪਰ ਮੇਰੇ ਦਿਮਾਗ ਵਿੱਚ ਉਸ ਚਿੜੀ ਦੀ ਛਾਪ ਅੱਜ ਵੀ ਹੈ ਪਤਾ ਨੀ ਉਸ ਵਿੱਚ ਅਜਿਹਾ ਕੀ ਸੀ ਜਿਹੜਾ ਕਿ ਮੈਨੂੰ ਹੋਰ ਪੰਛੀਆਂ ਵਿੱਚ ਨਹੀਂ ਲੱਗਿਆ ਸ਼ਾਇਦ ਉਸਦਾ ਰੰਗ ਉਸਦੀ ਵਾਜ ਉਸਦੀ ਸ਼ਕਲ ਜੋ ਕੀ ਮੈਂ ਪਹਿਲਾਂ ਕਦੇ ਨਹੀਂ ਵੇਖੀ ਸੀ ਧੰਨਵਾਦ